ਯੈਸ ਯੈਸ

ਹਾਂਜੀ ਮੈਮ ਸਤਿ ਸ਼੍ਰੀ ਅਕਾਲ ਮੈਮ ਬਹੁਤ ਵਧੀਆ ਮੈਮ ਤੁਸੀਂ ਸੁਣਾਓ ਮੈਮ ਵਧੀਆ ਚੱਲ ਰਿਹਾ ਕੰਮ ਮੇਰਾ ਮੈਂ ਮੈਮ ਇੱਥੇ ਐਜ ਏ ਐਚ ਆਰ ਕੰਮ ਕਰ ਰਿਹਾ ਅਤੇ ਹਾਂਜੀ ਹਾਂਜੀ ਹਾਇਰਿੰਗ ਦੇਖਦੇ ਹਾਂ ਅਸੀਂ ਅਤੇ ਨਾਲ ਆ ਜਿੰਨਾ ਵੀ ਹਾਂਜੀ ਡਿਟੇਸ ਜੋ ਵੀ ਡੀਟੇਨ ਕਰਨਾ ਹੁੰਦਾ ਪਟੀਸ਼ਨ ਹੁੰਦਾ ਉਹ ਸਾਰਾ ਹੀ ਦੇਖਦੇ ਹਾਂ ਬੇਸੀਕਲੀ ਹਾਂਜੀ ਹਾਂਜੀ ਓਕੇ ਤੁਸੀਂ ਅਤੇ ਤੁਹਾਡਾ ਗੁਰਪ੍ਰੀਤ ਨਾਮ ਹੈ ਓਕੇ ਐਕਚੁਲੀ ਹਾਂਜੀ ਬਿਲਕੁਲ ਠੀਕ ਹੈ ਮੈਨੂੰ ਲੱਗਿਆ ਕਿ ਕੋਈ ਦੂਜਾ ਪਰਸਨ ਗੱਲ ਕਰ ਰਿਹਾ ਅੱਛਾ ਗੁਰਪ੍ਰੀਤ ਮੇਰੇ ਕੋਲ ਇੱਕ ਓਪਨਿੰਗ ਸੀਗੀ ਆਪਣਾ ਪ੍ਰੋਜੈਕਟ ਕੋਆਡੀਨੇਟਰ ਦੀ ਅਤੇ ਤੁਸੀਂ ਉਹਦੇ ਲਈ ਤੁਸੀਂ ਉਹਦੇ ਲਈ ਆਈ ਜਸਟ ਯੂ ਨੋ ਗੋਟ ਯੂਅਰ ਨੰਬਰ ਮੈਂ ਆਈ ਟ੍ਰਾਈ ਟੂ ਯੂ ਨੋ ਕੋਨੈਕਟ ਵਿਧ ਯੂ ਮੈਂ ਕੋਸ਼ਿਸ਼ ਕੀਤੀ ਸੀਗੀ ਲੇਕਿਨ ਤੁਸੀਂ ਉਸ ਸਮੇਂ ਮੇਰੇ ਖਿਆਲ ਤੋਂ ਬਿਜ਼ੀ ਸੀਗੇ ਅਤੇ ਮੈਨੂੰ ਹੁਣ ਸਹੀ ਟਾਈਮ ਤੁਹਾਡੇ ਨਾਲ ਗੱਲ ਕਰਨ ਲਈ ਠੀਕ ਹੈ ਠੀਕ ਹੈ ਮੈਮ ਠੀਕ ਹੈ ਅੱਛਾ ਗ ਗੁਰਪ੍ਰੀਤ ਜੀ ਤੁਸੀਂ ਇਹ ਦੱਸੋ ਕਿ ਤੁਸੀਂ ਕੀਤਾ ਕੀ ਹੋਇਆ ਬੇਸੀਕਲੀ ਕੀ ਕੁਆਲੀਫੀਕੇਸ਼ਨ ਤੁਹਾਡੀ ਠੀਕ ਹੈ ਠੀਕ ਹੈ ਮੇਰੇ ਕੋਲ ਜਿਹੜੀ ਪ੍ਰੋਫਾਈਲ ਸੀਗੀ ਉਹ ਪ੍ਰੋਜੈਕਟ ਕੋਆਡੀਨੇਟਰ ਦੀ ਸੀਗੀ ਅਤੇ ਜਿੱਦਾਂ ਮੈਂ ਤੁਹਾਡੀ ਪ੍ਰੋਫਾਈਲ ਵੇਖ ਦੇਖ ਰਿਹਾ ਸੀਗਾ ਨੌਕਰੀ ਡੋਟ ਕੋਮ 'ਤੇ ਤੁਸੀਂ ਅਪਲੋਡ ਕੀਤਾ ਸੀਗਾ ਅਤੇ ਉਸ ਉਸ ਹਿਸਾਬ ਨਾਲ ਤੁਹਾਡੀ ਪ੍ਰੋਫਾਈਲ ਮੈਚ ਕਰ ਰਹੀ ਸੀਗੀ ਇਹਦੇ ਇਲਾਵਾ ਕੋਈ ਐਕਸਪੀਰੀਅੰਸ ਤੁਹਾਨੂੰ ਕੀ ਕੰਮ ਕੀਤਾ ਹੋਇਆ ਤੁਸੀਂ ਠੀਕ ਹੈ ਜੀ ਠੀਕ ਹੈ ਓਕੇ ਓਕੇ ਓਕੇ ਠੀਕ ਹੈ ਜੀ ਬਟ ਗੁਰਪ੍ਰੀਤ ਜੀ ਮੇਰੇ ਕੋਲ ਜੋ ਪ੍ਰੋਫਾਈਲ ਹੈ ਉਹ ਪ੍ਰੋਜੈਕਟ ਕੋਆਡੀਨੇਟਰ ਦੀ ਆ ਤੁਸੀਂ ਤੁਹਾਡਾ ਤਾਂ ਐਕਸਪੀਰੀਅੰਸ ਸਾਰਾ ਟੀਚਿੰਗ ਦਾ ਹੀ ਹੈ ਅਤੇ ਮੈਨੇਜ ਕਰ ਲਉਂਗੇ ਜਿਹੜੀ ਪ੍ਰੋਫਾਈਲ ਹੁਣ ਤੁਹਾਨੂੰ ਮੈਂ ਪਿਚ ਕਰ ਰਿਹਾ ਕਿਉਂਕਿ ਹੁਣ ਕੀ ਕਰ ਰਹੇ ਹੋ ਤੁਸੀਂ ਆ ਫਿਲਹਾਲ ਅਤੇ ਮੈਂ ਉਹ ਹੀ ਪੁੱਛ ਰਿਹਾ ਸਾਨੂੰ ਹੁਣ ਤੁਸੀਂ ਜਿੱਦਾਂ ਜੋਬ ਸਰਚ ਕਰ ਰਹੇ ਹੋ ਅਤੇ ਪ੍ਰੋਫਾਈਲ ਟੀਚਿੰਗ ਦੀ ਅਤੇ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਪ੍ਰੋਜੈਕਟ ਕੋਆਡੀਨੇਟਰ ਦੀ ਹੈ ਤੁਹਾਡੇ ਲਈ ਠੀਕ ਰਹੇਗੀ

ਚਲੋ ਅੱਛੀ ਗੱਲ ਹੈ ਅਤੇ ਕਦੋਂ ਹੋਈ ਮੈਰਿਜ ਤੁਹਾਡੀ ਠੀਕ ਹੈ ਅਤੇ ਜੋਬ ਕਦੋਂ ਲੈਫਟ ਕੀਤੀ ਸੀ ਠੀਕ ਹੈ ਅਤੇ ਕਿੰਨੀ ਸੈਲਰੀ ਲੈ ਰਹੇ ਸੀ ਉੱਥੇ ਜੀ ਠੀਕ ਹੈ ਠੀਕ ਹੈ ਅਤੇ ਕਿੰਨਾ ਐਕਸਪੀਰੀਅੰਸ ਟੋਟਲ ਤੁਹਾਡਾ ਕਿੰਨਾ ਐਕਸਪੀਰੀਅੰਸ ਹੋ ਗਿਆ

ਠੀਕ ਹੈ ਜੀ ਠੀਕ ਹੈ ਤੇ ਗੁਰਪ੍ਰੀਤ ਜੀ ਇੱਦਾਂ ਹੈ ਕਿ ਦੇਖੋ ਤੁਹਾਡੀ ਪ੍ਰੋਫਾਈਲ ਜਿਹੜੀ ਹੈਗੀ ਹੈ ਠੀਕ ਹੈ ਮੈਂ ਤਾਂ ਤੁਹਾਨੂੰ ਇੰਨਾ ਹੀ ਪੇ ਕਰ ਪਾਵਾਂਗਾ ਦੇਖੋ ਪ੍ਰੋਫਾਈਲ ਜਿਹੜੀ ਪ੍ਰੋਝੈਕਟ ਕੋਆਡੀਨੇਟਰ ਦੀ ਹੈਗੀ ਆ ਤੁਹਾਡੇ ਕੁਆਲੀਫੀਕੇਸ਼ਨ ਤੁਹਾਡੇ ਕਮਨੀਕੇਸ਼ਨ ਸਾਰਾ ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਉਹ ਬਿਲਕੁਲ ਮੈਚ ਕਰ ਰਿਹਾ ਸੋ ਅੱਗੇ ਤੁਸੀਂ ਲਰਨਿੰਗ ਤੁਹਾਨੂੰ ਟੀਚ ਵੀ ਟ੍ਰੇਨਿੰਗ ਵੀ ਦੇਵਾਂਗੇ ਇਸ ਪ੍ਰੋਫਾਈਲ ਦੇ ਲਈ ਐਟਲੀਸਟ ਤੁਹਾਨੂੰ ਵੰਨ ਮੰਨਥ ਤੁਹਾਨੂੰ ਪ੍ਰੋਪਰਲੀ ਗਾਈਡ ਕਰਾਂਗੇ ਬਟ ਸੈਲਰੀ ਪੈਕਜ ਤੁਹਾਨੂੰ ਅਸੀਂ ਥਰਟੀ ਥਾਊਜੈਂਟ ਹੀ ਦੇਵਾਂਗੇ ਕਿਉਂਕਿ ਸਾਡੇ ਤੋਂ ਤੁਹਾਡਾ ਐਕਸਪੀਰੀਅੰਸ ਜਿਹੜਾ ਹੈਗਾ ਉਹ ਟੀਚਿੰਗ ਦਾ ਸੀਗਾ ਬਟ ਸਾਡੀ ਸਟਾਰਟਿੰਗ ਸੈਲਰੀ ਪੈਕਜ ਹੀ ਅਸੀਂ ਤੀਹ ਹਜ਼ਾਰ ਦਿੰਦੇ ਹਾਂ ਕੈਂਡੀਡੇਟ ਨੂੰ ਚਾਹੇ ਉਹ ਫਰੈਸ਼ਰ ਹੈ ਚਾਹੇ ਉਹ ਐਕਸਪੀਰੀਅੰਸ ਹੈ ਪਰ ਤੁਹਾਡਾ ਮੈਂ ਟਵੰਟੀ ਫਾਈਵ ਦਿੰਦੇ ਹਾਂ ਤੁਹਾਨੂੰ ਥ ਫਾਈਵ ਥਾਊਸੈਂਡ ਐਕਸਟਰਾ ਕਰ ਰਿਹਾ ਜੇ ਤੁਹਾਡਾ ਐਕਸਪੀਰੀਸ ਥੋੜ੍ਹਾ ਯੋਗ ਹੈਗਾ ਸੀਗਾ ਪਰ ਜਿੱਦਾਂ ਜਿੱਦਾਂ ਅੱਗੇ ਚੱਲਾਂਗੇ ਸਾਡੇ ਗਰੋਥ ਕੋਇੰਨ ਦੇ ਹਿਸਾਬ ਨਾਲ ਹੀ ਆਫਟਰ ਸਿਕਸ ਮੰਨਥ ਬਾਅਦ ਹੀ ਤੁਹਾਨੂੰ ਹਾਇਕ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਉਹ ਤੁਹਾਡੇ ਡਿਪੈਂਡ ਤੁਹਾਡੀ ਪ੍ਰੋਡਕਟੀਵਿਟੀ ਦੇ ਉੱਤੇ ਆ ਠੀਕ ਹੈ ਜੀ ਹਾਂਜੀ ਹਾਂਜੀ ਅਤੇ ਤੁਸੀਂ ਕਦੋਂ ਜੁਆਇੰਨ ਕਰ ਸਕਦੇ ਹੋ ਤੁਸੀਂ ਮੰਡੇ ਤੋਂ ਜੁਇਨਿੰਗ ਕਰ ਲਓ ਅੱਜ ਫਰਾਈਡੇ ਹੈਗਾ ਅ ਥਰਸਡੇ ਹੈਗਾ ਤੁਸੀਂ ਮੰਡੇ ਜੁਇਨਿੰਗ ਕਰ ਲਓ ਅਤੇ ਟਾਈਮਿੰਗ ਆਪਣੀ ਨਾਈਨ ਟੂ ਵਾਲੀ ਜਨਰਲ ਸ਼ਿਫਟ ਰਹੇਗੀ ਨਾਈਨ ਟੂ ਸਿਕਸ ਅਤੇ ਫਾਈਵ ਡੇਜ ਵਰਕਿੰਗ ਰਹੇਗਾ ਠੀਕ ਹੈ ਜੀ ਅਤੇ ਸੈਲਰੀ ਤਿੰਨ ਚਾਰ ਤਰੀਕ ਨੂੰ ਆ ਜਾਂਦੀ ਸਾਡੇ ਇੱਥੇ ਠੀਕ ਹੈ ਜੀ ਚਲ ਬਾਕੀ ਇੱਕ ਵਾਰੀ ਫੇਸ ਟੂ ਫੇਸ ਅਤੇ ਜਿਹੜਾ ਵੀ ਇੰਟਰਵਿਊ ਹੋਵੇਗਾ ਇੱਕ ਵਾਰੀ ਮੈਂ ਤੁਹਾਨੂੰ ਗਾਈਡ ਕਰ ਦਾਂਗਾ ਔਫਿਸ ਆ ਕੇ ਥੋੜ੍ਹਾ ਸਮਝਾ ਦਾਂਗਾ ਠੀਕ ਹੈ ਗੁਰਪ੍ਰੀਤ ਜੀ ਠੀਕ ਹੈ ਜੀ ਓਕੇ ਜੀ ਵੈਲਕਮ ਜੀ ਵੈਲਕਮ ਓਕੇ ਜੀ